ਸਤਿ ਸ੍ਰੀ ਅਕਾਲ ਸਰ ਅਸੀਂ ਗਾਈਆਂ ਬਾਰੇ ਜਾਣਦੇ ਹਾਂ ਅਸੀਂ ਗਾਈਆਂ ਦੇ ਸਾਡੇ ਖੇਤਰ ਵਿੱਚ ਗਾਈਆਂ ਕਿਸ ਤਰ੍ਹਾਂ ਰੱਖਣੀਆਂ ਪੈਂਦੀਆਂ ਇਹਨਾਂ ਦੀ ਦੇਖ ਰੇਖ ਕਰਨੀ ਬਹੁਤ ਜ਼ਰੂਰੀ ਹੈ ਗਾਈਆਂ ਜਦੋਂ ਗਾਈਆਂ ਜਦੋਂ ਬੋਲਦੀ ਹੈ ਅਸੀਂ ਉਹਨਾਂ ਦਾ ਵੈਰ ਦੇਖ ਕੇ ਅਸੀਂ ਡਾਕਟਰਾਂ ਨੂੰ ਸੱਦ ਲੈਂਦੇ ਹਾਂ ਇਸ ਕਰਕੇ ਉਹਨਾਂ ਨੂੰ ਅਸੀਂ ਉਹਨਾਂ ਦੇ ਵੈਰ ਤੋਂ ਡਾਕਟਰ ਵੱਲੋਂ ਟੀਕਾ ਲਵਾ ਲੈਂਦੇ ਹਾਂ ਇਸ ਕਰਕੇ ਉਹ ਗਾਈਆਂ ਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਇਸ ਕਰਕੇ ਗਾਂ ਨੂੰ ਕੋਈ ਗਰਮ ਚੀਜ਼ਾਂ ਨਹੀਂ ਦੇਣੀਆਂ ਗਾਂ ਨੂੰ ਆਪਣੇ ਆਪਣੇ ਨਾਹ ਧੋ ਕੇ ਠੰ ਠੰਡੀਆਂ ਚੀਜ਼ਾਂ ਦਵੋ ਇਸ ਕਰਕੇ ਸਾਡਾ ਗਾਂ ਦਾ ਖੇਤਰ ਬਹੁਤ ਚੰਗਾ ਰਹੇਗਾ